ਸਾਡੇ ਬਜ਼ੁਰਗ ਨੇ ਜਿਹੜੇ ਉਹ ਰੰਬੀ ਨਾਲ ਗੋਡੀ ਕਰਦੇ ਨੇ ਹੈਂ ਕਿ ਫਸਲ ਜਿਹੜੀ ਹੈ ਚੰਗੀ ਹੋ ਜਾਂਦੀ ਹੈ ਪਾਣੀ ਦਿੰਦੇ ਨੇ ਦਾਤਰੀ ਨਾਲ ਵਾਢੀ ਕਰਦੇ ਆ ਅਸੀਂ ਦੇਖਦੇ ਰਹਿੰਦੇ ਹਾਂ ਸਾਡੇ ਬਜ਼ੁਰਗ ਕੀ ਕਰਦੇ ਆ ਬੜੇ ਖੁਸ਼ ਹੁੰਦੇ ਨੇ ਫਸਲ ਬਹੁਤ ਵਧੀਆ ਬਣਦੀ ਹੈ ਸਾਨੂੰ ਗਮਲਿਆਂ 'ਚ ਫੁੱਲ ਲਾਏ ਦੇ ਨੇ ਉਹਨਾਂ ਦੀ ਗੋਡੀ ਕਰਦੇ ਨੇ ਪਾਣੀ ਦਿੰਦੇ ਨੇ ਉਹਨਾਂ ਨੂੰ ਸਾਂਭ ਲੈਂਦੇ ਅੱਛੀ ਤਰ੍ਹਾਂ ਸਾਂਭਦੇ ਨੇ ਹੈਂ ਅਸੀਂ ਬੜੇ ਖੁਸ਼ ਹੁੰਦੇ ਹਾਂ ਖੁਸ਼ ਹੋ ਕੇ ਜਾਂਦੇ ਹਾਂ ਅਸੀਂ ਪਾਈਪਾਂ ਲਾਈ ਦੀਆਂ ਨੇ ਪਾ ਪਾਣੀ ਦੇਣ ਵਾਸਤੇ ਸਾਰਾ ਹੀ ਕੰਮ ਉਹ ਹੀ ਕਰਦੇ ਨੇ ਸਾਡੇ ਬੱਚੇ ਨੇ ਜਿਹੜੇ ਬੜੇ ਖੁਸ਼ ਹੁੰਦੇ ਨੇ ਦੇਖ ਦੇਖ ਸਾਨੂੰ ਵੀ ਬੂਟਿਆਂ ਨੂੰ ਪਾਣੀ ਦੇਣ ਦਾ ਬੜਾ ਸ਼ੌਂਕ ਹੈ ਅਸੀਂ ਵੀ ਬੂਟਿਆਂ ਨੂੰ ਪਾਣੀ ਦਿੰਦੇ ਰਹਿੰਦੇ ਹਾਂ ਗੋਡੀ ਕਰਦੇ ਰਹਿੰਦੇ ਹਾਂ ਨਵੇਂ ਨਵੇਂ ਫੁੱਲ ਲੱਗੇ ਵੇ ਹੋਣ ਬੜੇ ਸੋਹਣੇ ਲੱਗਦੇ ਨੇ ਦੇਖਦੇ ਰਹਿੰਦੇ ਹਾਂ ਘਰ ਦੇ ਵਿੱਚ ਸਬਜ਼ੀਆਂ ਵੀ ਲਾਈਦੀਆਂ ਨੇ ਪਲਾਟਾ 'ਚ ਬੜੇ